ਪੰਜ ਜੂਨ ਦੋ ਹਜ਼ਾਰ ਇੱਕੀ ਪੰਦਰਾਂ ਸਪਤੰਬਰ ਦੋ ਹਜ਼ਾਰ ਇੱਕੀ ਦਸ ਜਨਵਰੀ ਦੋ ਹਜ਼ਾਰ ਬਾਈ ਚੌਦ੍ਹਾਂ ਅਗਸਤ ਦੋ ਹਜ਼ਾਰ ਬਾਈ ਨੌ ਉੱਨੀ ਮਈ ਦੋ ਹਜ਼ਾਰ ਤੇਈ